ਹੈਲੋ ਹਾਂਜੀ ਮੈਮ ਦੱਸੋ ਹਾਂਜੀ ਬੋਲੋ ਮੈਮ ਦੱਸੋ ਅੱਛਾ ਮੈਮ ਤੁਸੀਂ ਤੁਹਾਡਾ ਮੈਨੂੰ ਸੀਟ ਨੰਬਰ ਦੱਸੋ ਤੁਸੀਂ ਕਿਹੜੀ ਸੀਟ 'ਤੇ ਹੋ ਠੀਕ ਹੈ ਮੈਮ ਮੈਮ ਕੀ ਦਿੱਕਤ ਹੈ ਤੁਹਾਨੂੰ ਅੱਛਾ ਠੀਕ ਹੈ ਮੈਮ ਮੈਮ ਤੁਹਾਨੂੰ ਰੁਕਣਾ ਪਵੇਗਾ ਪੰਜ ਦਸ ਮਿੰਟ ਜਦੋਂ ਵੀ ਅਗਲਾ ਸਟੇਸ਼ਨ ਆਉਂਦਾ ਤਾਂ ਸਵਾਰੀਆਂ ਉੱਤਰਨਗੀਆਂ ਤਾਂ ਮੈਂ ਤੁਹਾਡੀ ਸੀਟ ਐਕਸਚੇਂਜ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੀ ਮੈਮ ਜਲਦੀ ਤਾਂ ਹੁਣ ਦੇਖੋ ਤੁਹਾਨੂੰ ਵੀ ਪਤਾ ਹੈ ਜਿਵੇਂ ਜਿਵੇਂ ਸਵਾਰੀਆਂ ਖੜ੍ਹੀਆਂ ਹੋਣਗੀਆਂ ਫੇਰ ਹੀ ਅਸੀਂ ਸੀਟ ਦੇਵਾਂਗੇ ਹੁਣ ਜੇ ਅਚਾਨਕ ਕਿਸੇ ਨੂੰ ਕਹਿਤਾ ਤਾਂ ਉਹ ਕਸਟਮਰ ਵੀ ਫੇਰ ਸਾਡਾ ਅੱਗੋਂ ਬੋਲਦਾ ਵੀ ਸਾਡੇ ਨਾਲ ਹੀ ਐਵੇਂ ਕਿਉਂ ਅਤੇ ਮੈਮ ਤੁਸੀਂ ਮੈਨੂੰ ਐਵੇਂ ਦੱਸ ਦਿਉ ਤੁਸੀਂ ਜਾਣਾ ਕਿੱਥੇ ਤੱਕ ਹੈ ਤੁਹਾਡਾ ਟੂਰ ਕਿੰਨੇ ਕੁ ਦੂਰ ਹੈਗਾ ਅੱਛਾ ਅਤੇ ਮੈਮ ਤੁਹਾਨੂੰ ਥੋੜ੍ਹਾ ਤਾਂ ਰੁਕਣਾ ਪਵੇਗਾ ਅਗਲਾ ਸਟੇਸ਼ਨ ਆਉਣ ਤੱਕ ਅਤੇ ਜਦੋਂ ਵੀ ਅਗਲੀ ਸੀਟ ਕੋਈ ਖਾਲੀ ਹੁੰਦੀ ਹੈ ਤਾਂ ਮੈਂ ਤੁਹਾਨੂੰ ਬੁਲਾ ਲਵਾਂਗੀ ਅਤੇ ਤੁਸੀਂ ਆ ਕੇ ਉੱਥੇ ਕੰਫਰਟੇਬਲ ਬੈਠ ਜਾਇਓ ਜੇ ਅਤੇ ਥੋੜ੍ਹਾ ਟਾਈਮ ਤਾਂ ਤੁਹਾਨੂੰ ਐਡਜਸਟ ਕਰਨਾ ਹੀ ਪੈਣਾ ਮੈਮ ਮੈਂ ਹਾਂਜੀ ਹਾਂਜੀ ਠੀਕ ਹੈ ਸਫ਼ਾਈ ਤਾਂ ਕਰਵਾਈ ਸੀ ਪਰ ਕੀ ਹੁੰਦਾ ਕਿ ਬੱਸ ਐਨੀ ਦੇਰ ਤੋਂ ਚੱਲ ਰਹੀ ਹੈ ਤਾਂ ਕਰਕੇ ਜਿਵੇਂ ਜਿਵੇਂ ਆਉਂਦੀਆਂ ਨੇ ਪਸੈਂਜਰਸ ਆਉਂਦੇ ਹੈ ਅਤੇ ਉਹ ਗੰਦ ਖਿਲਾਰ ਕੇ ਚਲੇ ਜਾਂਦੇ ਹਨ ਥੋੜ੍ਹਾ ਪਸੈਂਜਰਸ ਨੂੰ ਵੀ ਆਪ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਗੰਦ ਨਾ ਖਿਲਾਰੀਏ

ਠੀਕ ਹੈ ਮੈਮ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਤੁਹਾਡੀ ਕੰਪਲੇਟਸ ਹੈ ਉਹਨੂੰ ਆਪਾਂ ਸੁਧਾਰੀਏ ਹੋਰ ਕੋਈ ਦਿੱਕਤ ਜੀ ਹਾਂਜੀ ਠੀਕ ਹੈ ਤੁਸੀਂ ਸੀਟ ਨੰਬਰ ਦੋ 'ਤੇ ਆ ਜਾਣਾ ਜਦੋਂ ਵੀ ਅਗਲਾ ਸਟੇਸ਼ਨ ਆਵੇਗਾ ਆਪਾਂ ਤੁਹਾਨੂੰ ਅੱਗੇ ਸੀਟ ਦਵਾ ਦਵਾਂਗੇ ਓਕੇ ਜੀ